ਖੇਤੀਬਾੜੀ ਪੰਜਾਬ ਦਾ ਮੁੱਖ ਕਿੱਤਾ ਹੈ ਖੇਤੀਬਾੜੀ 'ਚ ਪਸ਼ੂ ਪਾਲਣ ਡੇਅਰੀ ਫ਼ਸਲਾਂ ਦੀ ਬਿਜਾਈ ਕਟਾਈ ਸਬਜ਼ੀਆਂ ਦੀ ਬਿਜਾਈ ਸਾਰਾ ਕੁਛ ਆਉਂਦਾ ਹੈ ਪਹਿਲਾਂ ਜਿਹੜੇ ਲੋਕ ਸੀਗੇ ਉਹ ਸਿਰਫ਼ ਖੇਤੀਬਾੜੀ 'ਤੇ ਡਿਪੈਡ ਹੁੰਦੇ ਸੀ ਹੌਲੀ ਹੌਲੀ ਰੁਜ਼ਗਾਰ ਵਧੇ ਚੀਜ਼ਾਂ ਵਧੀਆਂ ਅਤੇ ਲੋਕ ਨੌਕਰੀਆਂ ਕਰਨ ਲੱਗ ਗਏ ਖੇਤੀ 'ਚ ਥੋੜ੍ਹਾ ਰੁਝਾ ਰੁਝਾਨ ਘਟਿਆ ਅਸਲ ਵਿੱਚ ਗੱਲ ਇਹ ਹੈ ਕਿ ਖੇਤੀਬਾੜੀ ਦਾ ਰੁਝਾਨ ਇਸ ਕਰਕੇ ਲੋਕਾਂ 'ਚ ਘਟਿਆ ਕਿਉਂਕਿ ਉਨ੍ਹਾਂ ਨੂੰ ਪਰੋਪਰ ਮੁੱਲ ਨਹੀਂ ਮਿਲਦੇ ਕਿਸਾਨਾਂ ਨਾਲ ਬਹੁਤ ਧੱਕਾ ਹੁੰਦਾ ਹੈ ਇੱਕ ਕਦੀ ਮੌਸਮ ਦੀ ਗੜਿਆਂ ਦੀ ਮਾਰ ਫ਼ਸਲ ਖਰਾਬ ਹੋ ਜਾਂਦੀ ਹੈ ਕਦੀ ਬਾਰਿਸ਼ ਹਨੇਰੀ ਤੂਫ਼ਾਨ ਇਹੋ ਜਿਹੀਆਂ ਚੀਜ਼ਾਂ ਨਾਲ ਫ਼ਸਲ 'ਤੇ ਬਹੁਤ ਕੁਦਰਤ ਦੀ ਮਾਰ ਕਹਿ ਲਉ ਬਹੁਤ ਅਸਰ ਪਾਉਂਦੀ ਹੈ ਉਸ ਤੋਂ ਬਾਅਦ ਜਦੋਂ ਕਿਸਾਨ ਸਰਕਾਰ ਤੋਂ ਉਮੀਦ ਕਰਦੇ ਨੇ ਕਿ ਸਰਕਾਰ ਉਨ੍ਹਾਂ ਨੂੰ ਮੁਨਾਫ਼ਾ ਕੁਛ ਫ਼ਸਲਾਂ ਦਾ ਪਰੋਪਰ ਮੁੱਲ ਦੇਵੇ ਜਾਂ ਹੋਏ ਨੁਕਸਾਨ ਦੀ ਭਰਪਾਈ ਕਰੇ ਤਾਂ ਸਰਕਾਰ ਹੱਥ ਖੜ੍ਹੇ ਕਰ ਦਿੰਦੀ ਹੈ ਇਹ ਤਾਂ ਦੂਰ ਦੀ ਗੱਲ ਹੈ ਮੁਨਾਫ਼ੇ ਦੇਣੇ ਤਾਂ ਉਹ ਤਾਂ ਉਨ੍ਹਾਂ ਨੂੰ ਉਸ ਚੀਜ਼ ਦਾ ਨੁਕਸਾਨ ਦੀ ਭਰਪਾਈ ਵੀ ਨਹੀਂ ਕਰਦੀ ਕਿਸਾਨ ਮਜ਼ਬੂਰੀ ਵਜੋਂ ਆਪਣੇ ਬੱਚਿਆਂ ਨੂੰ ਪਾਲਣ ਲਈ ਖੇਤੀ ਛੱਡਦੇ ਜਾ ਰਹੇ ਨੇ ਅਤੇ ਲੋਕ ਜਿਹੜੇ ਅੱਜ ਕੱਲ੍ਹ ਦਾ ਯੂਥ ਹੈ ਉਨ੍ਹਾਂ ਨੂੰ ਲੱਗਦਾ ਹੈ ਕਿ ਸ਼ਾਇਦ ਪੰਜਾਬ 'ਚ ਪੰਜਾਬ ਦਾ ਜਿਹੜਾ ਮੁੱਖ ਕਿੱਤਾ ਸੀ ਖੇਤੀ ਜਦ ਉਹੀ ਨਹੀਂ ਰਿਹਾ ਅਤੇ ਫੇਰ ਹੋਰ ਚੀਜ਼ਾਂ ਕਿੱਥੇ ਰਹਿਣਗੀਆਂ ਬੇਰੁਜ਼ਗਾਰੀ ਐਨੀ ਵਧੀ ਜਾ ਰਹੀ ਹੈ ਉਹ ਬਾਹਰ ਜਾ ਰਹੇ ਨੇ ਖੇਤੀ ਛੁੱਟਦੀ ਜਾ ਰਹੀ ਹੈ ਦਿਨੋਂ ਦਿਨ ਅਤੇ ਜ਼ਮੀਨਾਂ ਜਿਹੜੀਆਂ ਨੇ ਉਹਨੂੰ ਕੱਟ ਕੱਟ ਕੇ ਪਲੋਟ ਬਣਾਏ ਜਾਂਦੇ ਨੇ ਸੜਕਾਂ ਬਣਾਈ ਜਾਂਦੇ ਨੇ ਰੇਲਾਂ ਦੀਆਂ ਲਾਈਨਾਂ ਕੱਢੀ ਜਾਂਦੇ ਨੇ ਪਰ ਕੁਛ ਲੋਕ ਅਜੇ ਵੀ ਇਹ ਜਿਹੇ ਨੇ ਜਿਹੜੇ ਬਾਹਰੋਂ ਪਰਤ ਕੇ ਆ ਕੇ ਖੇਤੀ ਕਰਨਾ ਚਾਹੁੰਦੇ ਨੇ ਪਰ ਮੇਰੀ ਨਜ਼ਰ 'ਚ ਇਹ ਹੈ ਕਿ ਸਾਨੂੰ ਆਪਣਾ ਮੁੱਖ ਕਿੱਤਾ ਖੇਤੀ ਸੰਭਾਲਣਾ ਚਾਹੀਦਾ ਹੈ ਪੰਜਾਬ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਹੈ ਸੋਨੇ ਦੀ ਚਿੜੀ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਪੰਜਾਬ ਦੀ ਮਿੱਟੀ 'ਚੋਂ ਕਿਸਾਨ ਸੋਨਾ ਉਗਾਉਂਦਾ ਹੈ ਯਾਨੀ ਸੋਨੇ ਦਾ ਭਾਵ ਅੰਨ ਉਗਾਉਂਦਾ ਹੈ ਜਿਹਦੇ ਨਾਲ ਲੋਕਾਂ ਦਾ ਢਿੱਡ ਭਰਦਾ ਹੈ ਕੁਝ ਸਭ ਕੁਛ ਅੱਛਾ ਰੁਜ਼ਗਾਰ ਮਿਲਦਾ ਹੈ ਅੰਨ ਢਿੱਡ ਭਰੀ ਜਾਂਦੇ ਨੇ ਸਕੂਨ ਮਿਲਦਾ ਹੈ ਲੋਕਾਂ ਨੂੰ ਕੰਮ ਕਰਕੇ ਖੇਤੀ ਦੇ ਕਿੱਤੇ ਤੋਂ ਸੋ ਇਹ ਬੇਨਤੀ ਹੈ ਕਿ ਨਾ ਛੱਡਿਆ ਜਾਵੇ ਕਿੱਤਾ ਪੰਜਾਬ ਦੇ ਮੁੱਖ ਕਿੱਤੇ ਨੂੰ ਅਪਣਾਇਆ ਜਾਵੇ ਪੰਜਾਬ ਨੂੰ ਮੁ ਮੁੜ ਤੋਂ ਸੋਨੇ ਦੀ ਚਿੜੀ ਬਣਾਇਆ ਜਾਵੇ